ਮੈਨੂੰ ਵੱਖ ਵੱਖ ਕਮੀਆਂ ਨੂੰ ਪੜ੍ਹਨਾ ਬਹੁਤ ਵਧੀਆ ਲੱਗਦਾ ਹੈ ਅਤੇ ਉਹਨਾਂ ਦੀ ਲਖ ਲਿਖਾਈ ਵਿੱਚੋਂ ਜੋ ਵੀ ਮੈਂ ਸਿੱਖ ਸਕਦਾ ਉਹ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ